ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਆਰਤੀ ਮੈਂ ਪਠਾਨਕੋਟ ਤੋਂ ਬੋਲਦੀ ਪਈ ਐਂ ਸਰ ਯੋਗਾ ਕਰਨ ਦੇ ਅਨੁਸਾਰ ਉਮਰ ਕੋਈ ਨਹੀਂ ਹੁੰਦੀ ਛੋਟੀ ਉਮਰ ਤੋਂ ਹੀ ਯੋਗਾ ਸ਼ੁਰੂ ਕਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਜੋ ਯੋਗਾ ਕਰਨ ਦੇ ਬਹੁਤ ਸਾਰੇ ਫਾਇਦੇ ਹੁੰਦੇ ਸਾਡੇ ਸਰੀਰ ਨੂੰ ਜਿਸ ਤਰ੍ਹਾਂ ਕਿ ਆਰਾਮ ਮਿਲਦਾ ਯੋਗਾ ਕਰਨ ਨਾਲ ਕਈ ਬਿਮਾਰੀਆਂ ਦੂਰ ਜਾਂਦੀਆਂ ਨੇ ਜਿਸ ਤਰ੍ਹਾਂ ਕਿ ਬੈਠ ਕੇ ਯੋਗਾ ਕਰਨ ਨਾਲ ਬਹੁਤ ਸਾਰੀਆਂ ਬਿਮਾਰੀਆਂ ਘੱਟ ਹੁੰਦੀਆਂ ਸਾਡੇ ਸਰੀਰ ਦੀਆਂ ਜਿਸ ਤਰ੍ਹਾਂ ਕਿ ਬੁਖਾਰ ਦਰਦ ਸਰੀਰ ਵਿੱਚ ਕੋਈ ਵੀ ਪ੍ਰੋਬਲਮ ਹੋਏ ਯੋਗਾ ਕਰਨ ਦੇ ਬਹੁਤ ਸਾਰੇ ਫਾਇਦੇ ਹੁੰਦੇ ਹੈ ਜਿਸ ਤਰ੍ਹਾਂ ਕਿ ਸਾਡੇ ਸਰੀਰ ਨੂੰ ਸਰਵਾਇਕਲ ਜਾਂ ਕੁਛ ਵੀ ਜਿਸ ਤਰ੍ਹਾਂ ਸਾਡਾ ਬਲੱਡ ਸਿਸਟਮ ਨਾ ਸਹੀ ਹੋਏ ਚੱਲਦਾ ਪਿਆ ਹੋਏ ਜਿਸ ਤਰ੍ਹਾਂ ਕਿ ਸਾਡੇ ਸਰੀਰ ਵਿੱਚ ਖੂਨ ਸੰਘਣਾ ਹੋਣ ਕਾਰਨ ਸਾਨੂੰ ਕਈ ਬਿਮਾਰੀਆਂ ਲੱਗ ਜਾਂਦੀਆਂ ਹੈ ਜਿਸ ਤਰ੍ਹਾਂ ਕਿ ਅਸੀਂ ਯੋਗਾ ਕਰਨ ਨਾਲ ਆਪਣੇ ਸਰੀਰ ਨੂੰ ਐਕਟਿਵ ਰੱਖਦੇ ਐ ਜਿਸ ਤਰ੍ਹਾਂ ਕਿ ਯੋਗਾ ਕਰਨ ਨਾਲ ਬਹੁਤ ਜ਼ਿਆਦਾ ਫਾਇਦੇ ਹੁੰਦੇ ਹੈ ਸਰ ਜਿਸ ਤਰ੍ਹਾਂ ਕਿ ਸਾਡੇ ਸਰੀਰ ਨੂੰ ਜਿਸ ਤਰ੍ਹਾਂ ਹੋਰ ਵੀ ਕਈ ਜ਼ਿਆਦਾ ਫਾਇਦੇ ਮਿਲਦੇ ਹੈ ਯੋਗਾ ਕਰਨ ਨਾਲ ਯੋਗਾ ਕਰਨ ਦਾ ਸਹੀ ਤਰੀਕਾ ਛੋਟੀ ਉਮਰ ਵਿੱਚ ਹੀ ਹੋਣਾ ਚਾਹੀਦਾ ਹੈ ਛੋਟੀ ਉਮਰ ਵਿੱਚ ਹੀ ਸ਼ੁਰੂ ਕਰ ਦਿੱਤਾ ਜ਼ਿਆਦਾ ਕਰਕੇ ਮੈਂ ਆਪਣੇ ਬੱਚਿਆਂ ਨੂੰ ਛੋਟੀ ਹੀ ਉਮਰ ਵਿੱਚ ਯੋਗਾ ਕਰਨਾ ਸਿਖਾ ਦਿੱਤਾ ਹੈ ਜਿਸ ਤਰ੍ਹਾਂ ਕਿ ਸੁਬ ਸਵੇਰੇ ਉੱਠ ਕੇ ਸਾਨੂੰ ਯੋਗਾ ਕਰਨਾ ਚਾਹੀਦਾ ਹੈ ਸਾਡੇ ਸਰੀਰ ਦੇ ਕਈ ਬਲੱਡ ਸਿਸਟਮ ਸ਼ੁਰੂ ਚੱਲਦੇ ਰਹਿੰਦੇ ਨੇ ਜਿਸ ਤਰ੍ਹਾਂ ਕਿ ਸਿਰ ਦਰਦ ਵੀ ਦੂਰ ਹੋ ਜਾਂਦਾ ਹੈ ਜਿਸ ਤਰ੍ਹਾਂ ਸਾਡੇ ਹੱਥ ਪੈਰ ਨਹੀਂ ਚੱਲਦੇ ਸੌਂ ਜਾਂਦੇ ਨੇ ਇਸ ਤਰ੍ਹਾਂ ਵੱਧ ਤੋਂ ਵੱਧ ਕਈ ਬਿਮਾਰੀਆਂ ਦੇ ਇਲਾਜ ਹੁੰਦੇ ਯੋਗਾ ਕਰਨ ਨਾਲ ਕਿਉਂਕਿ ਸਾਤੇ ਸਰੀਰ ਨੂੰ ਚਲਾਉਣਾ ਯੋਗਾ ਹੀ ਫਾਇਦੇਮੰਦ ਹੁੰਦਾ ਹੈ ਸਤਿ ਸ਼੍ਰੀ ਅਕਾਲ ਸਰ ਓਕੇ ਥੈਂਕਿ ਊ